ਹੈਲੋ ਨਮਸਕਾਰ ਸਰ ਸਰ ਮੈਂ ਦਿਕਸ਼ਾ ਹਾਂ ਮੈਂ ਮੀਡੀਆ ਵੱਲੋਂ ਆਈ ਹਾਂ ਮੈਂ ਤੁਹਾਡੇ ਇਲਾਕੇ 'ਚ ਆਈ ਹਾਂ ਪਹਿਲੀ ਵਾਰ ਗੁਰਦਾਸਪੁਰ 'ਚ ਅਤੇ ਮੈਂ ਇਹ ਜਾਣਨਾ ਚਾਹੁੰਦੀ ਹਾਂ ਜਿਸ ਤਰ੍ਹਾਂ ਹੁਣ ਪਿੱਛੇ ਜਿਹੇ ਬਹੁਤ ਬਾਰਿਸ਼ਾ ਹੋਈਆਂ ਹੈ ਨਾ ਅਤੇ ਤੁਹਾਡੇ ਇਲਾਕੇ 'ਚ ਹੜ੍ਹ ਵੀ ਆਇਆ ਸੀ ਅਤੇ ਅਸੀਂ ਹੋਰ ਵੀ ਲੋਕਾਂ ਨਾਲ ਗੱਲ ਕੀਤੀ ਹੈ ਅਤੇ ਅਹੀਂ ਹੁਣ ਇਹ ਰਿਵਿਊ ਲੈਣਾ ਚਾਹੁੰਦੀ ਹਾਂ ਕਿ ਜਿਸ ਤਰ੍ਹਾਂ ਹੜ੍ਹ ਆਏ ਇਹਦੇ ਨਾਲ ਮਤਲਬ ਕੀ ਤੁਹਾਨੂੰ ਕੀ ਲੱਗਦਾ ਕਿ ਕੀ ਪ੍ਰਭਾਵ ਪਿਆ ਆ ਕੀ ਨੁਕਸਾਨ ਹੋਇਆ ਜਾਂ ਕੀ ਪ੍ਰਭਾਵ ਪਿਆ ਹੂੰ ਹੂੰ ਹੂੰ ਹੂੰ ਜੀ ਜੀ ਹਾਂਜੀ ਅੱਛਾ ਅੱਛਾ ਠੀਕ ਹੈ ਅਤੇ ਸਰ ਫਿਰ ਤੁਸੀਂ ਉਹ ਨਾ ਹਾਂਜੀ ਹਾਂਜੀ ਹਾਂਜੀ ਸਰ ਬੋਲੋ ਹਾਂਜੀ ਹਾਂਜੀ ਹਾਂਜੀ ਸਰ ਅਤੇ ਸਰ ਹੁਣ ਤੁਸੀਂ ਫਿਰ ਸਰਕਾਰ ਵੱਲੋਂ ਕੀ ਉਮ ਉਮੀਦ ਰੱਖਦੇ ਹੋ ਕੀ ਸਰਕਾਰ ਤੁਹਾਡੀ ਕਿਸ ਤਰ੍ਹਾਂ ਮਦਦ ਕਰ ਸਕਦੀ ਹੈ ਹੂੰ ਠੀਕ ਠੀਕ ਹੈ ਸਰ ਓਕੇ ਸਰ ਧੰਨਵਾਦ